ਅਸੀਂ ਖੇਤੀਬਾੜੀ ਵਿੱਚ ਕਿਸਾਨ ਭਰਾਵਾਂ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਘੱਟ ਰੇਟ 'ਚ ਅਤੇ ਵਧੀਆ ਕਿਸਮ ਦੇ ਬੀਜ ਦਿੱਤੇ ਜਾਣ ਤਾਂ ਜੋ ਉਹ ਆਪਣੀ ਫ਼ਸਲ ਦਾ ਵੱਧ ਝਾੜ ਪ੍ਰਾਪਤ ਕਰ ਸਕੇ ਇਸ ਨਾਲ ਕਿਸਾਨ ਵੀਰ ਨੂੰ ਕਿਸੇ ਵੀ ਤਰ੍ਹਾਂ ਦੀ ਖੇਤੀ ਕਰਨ ਵਿੱਚ ਜੋ ਪ੍ਰੋਬਲਮ ਆਉਂਦੀ ਹੈ ਜੋ ਕਿਸੇ ਮੰਨ ਲਓ ਕਿਸੇ ਸੰਦ ਦੀ ਲੋੜ ਹੈ ਜਿਵੇਂ ਹਲ ਸੁਹਾਗਾ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ ਜਾਂ ਉਹ ਆਪਸੀ ਭਾਈਚਾਰੇ ਤੋਂ ਜਦੋਂ ਲੋੜ ਹੋਵੇ ਤਾਂ ਉਹ ਉਹਨਾਂ ਤੋਂ ਲੈ ਸਕੇ ਜਾਂ ਭਾਈਚਾਰਾ ਵੀ ਦੇ ਸਕੇ ਇਸ ਨਾਲ ਵੀ ਆਪ ਆਪਣੀ ਫ਼ਸਲ ਨੂੰ ਵੀ ਉਹ ਅਸਾਨੀ ਨਾਲ ਬਿਨਾਂ ਕਿਸੇ ਦਿੱਕਤ ਤੋਂ ਉਹ ਫ਼ਸਲ ਨੂੰ ਬੀਜ ਸਕੇ ਇਸ ਨਾਲ ਉਹਨਾਂ ਦੀ ਆਪਸੀ ਭਾਈਚਾਰਕ ਸਬੰਧ ਬਣਿਆ ਰਹਿੰਦਾ ਹੈ ਕਿਸੇ ਵੀ ਕਿਸਮ ਦੀ ਕੋਈ ਵੀ ਫਾਈਨੈਂਸ਼ੀਅਲ ਲੋੜ ਜੋ ਕੋਈ ਮਾਡਲ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਉਹ ਆਪਸੀ ਭਾਈਚਾਰਾ ਬਣਨ ਕਾਰਨ ਵੀ ਉਹ ਇੱਕ ਦੂਸਰੇ ਦੀ ਮਦਦ ਕਰ ਸਕਦੇ ਹਨ ਅਤੇ ਉਹਨਾਂ ਨੂੰ ਮੰਨ ਲਓ ਫ਼ਸਲ ਦਾ ਝਾੜ ਲੈਣ ਤੋਂ ਬਾਅਦ ਉਹ ਫ਼ਸਲ ਦਾ ਵੀ ਮੁਹੱਈਆ ਮੰਡੀਕਰਨ ਵਿੱਚ ਕਰਵਾਇਆ ਜਾਵੇ